ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਦੁਗਰੀ ਲੁਧਿਆਣਾ ਤੋਂ ਗੱਲ ਕਰ ਰਿਹਾ ਹਾਂ ਮੈਂ ਆਪਣੇ ਲੈਂਡਲਾਈਨ ਦਾ ਬਿੱਲ ਇੱਕ ਇੰਟਰਨੈਟ ਬੈਂਕਿੰਗ ਦੇ ਥਰੂ ਪੇ ਕੀਤਾ ਸੀਗਾ ਅਤੇ ਮੈਨੂੰ ਹੁਣ ਉਹਦੇ ਸਟੇਟਸ ਜਿਹੜਾ ਹੁੰਦਾ ਜਿਹੜਾ ਉਹਦਾ ਉਹ ਪ੍ਰੋਪਰ ਸ਼ੋ ਨਹੀਂ ਹੁੰਦਾ ਪਿਆ ਹੈਗਾ ਅਤੇ ਮੈਂ ਇੱਕ ਤਵੱਜੋ ਦੇ ਵਿੱਚ ਹੈਗਾ ਕਿ ਜਿਹੜੀ ਮੈਂ ਪੇਮੈਂਟ ਕੀਤੀ ਹੈਗੀ ਆ ਉਹ ਸਹੀ ਜਗ੍ਹਾ ਪਹੁੰਚੀ ਹੈ ਕਿ ਨਹੀਂ ਪਹੁੰਚੀ ਹੈ ਕਿਉਂਕਿ ਮੈਨੂੰ ਜਿਹੜਾ ਉਹਦਾ ਸਟੇਟਸ ਹੈਗਾ ਹੈ ਉਹ ਹਲੇ ਸ਼ੋਅ ਨਹੀਂ ਹੋ ਰਿਹਾ ਹੈ ਅਤੇ ਕਿਰਪਾ ਕਰਕੇ ਤੁਸੀਂ ਆਪਣੇ ਸਿਸਟਮ ਦੇ ਵਿੱਚ ਚੈੱਕ ਕਰਕੇ ਦੱਸੋ ਕਿ ਜਿਹੜੀ ਮੈਂ ਪੇਮੈਂਟ ਕੀਤੀ ਹੈਗੀ ਹੈ ਉਹ ਤੁਹਾਡੇ ਸਿਸਟਮ ਦੇ ਵਿੱਚ ਸ਼ੋਅ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਮੈਂ ਕਿਉਂਕਿ ਉਹਦੇ ਵਿੱਚ ਆਪਣੇ ਮੇਰੇ ਇੱਥੇ ਐਪ ਵਿੱਚੋਂ ਮੇਰੇ ਬੈਂਕ ਦੇ ਵਿੱਚੋਂ ਪੈਸੇ ਕੱਟੇ ਗਏ ਹਨ ਅਤੇ ਕਿਰਪਾ ਕਰਕੇ ਮੈਨੂੰ ਇਹ ਦੱਸਿਆ ਜਾਵੇ ਕਿ ਮੇਰੀ ਜਿਹੜੀ ਲੈਂਡਲਾਈਨ ਦੀ ਬਿੱਲ ਦੀ ਪੇਮੈਂਟ ਹੋਈ ਹੈ ਉਹ ਸਫਲਤਾ ਪੂਰਵਕ ਤੁਹਾਡੇ ਕੋਲ ਤੁਹਾਡੇ ਬੈਂਕ ਦੇ ਵਿੱਚ ਪਹੁੰਚੀ ਹੈ ਕਿ ਨਹੀਂ ਪਹੁੰਚੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਮੈਨੂੰ ਮੇਰਾ ਸਟੇਟਸ ਸਹੀ ਨਹੀਂ ਦਿਖਾ ਰਿਹਾ ਹੈ